ਸਾਨੂੰ ਸਰੀਰ ਦੀ ਤੰਦਰੁਸਤੀ ਲਈ ਬਹੁਤ ਜ਼ਿਆਦਾ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ ਜੇਕਰ ਆਪਾਂ ਸਰੀਰ ਦੀ ਤੰਦਰੁਸਤੀ ਦਾ ਧਿਆਨ ਨਹੀਂ ਰੱਖਾਂਗੇ ਅਤੇ ਸਾਡਾ ਸਰੀਰ ਬੇਕਾਰ ਹੋ ਜਾਵੇਗਾ ਕਿਉਂਕਿ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਨਿਯਮਾਂ ਦਾ ਪਾਲਣ ਹੋਣਾ ਬਹੁਤ ਜ਼ਰੂਰੀ ਹੈ ਕਈ ਲੋਕ ਖੰਡ ਦਾ ਪ੍ਰਹੇਜ਼ ਨਹੀਂ ਕਰਦੇ ਅਤੇ ਸ਼ੂਗਰ ਹੋ ਜਾਂਦੀ ਹੈ ਜਿਸ ਕਾਰਨ ਸ਼ੂਗਰ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਜੇਕਰ ਆਪਾਂ ਚੀਨੀ ਬਿਨਾਂ ਮਤਲਬ ਤੋੋਂ ਖਾਈ ਜਾਵਾਂਗੇ ਤਾਂ ਸਾਡੇ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਜਾਂਦੀ ਹੈ ਮੋਟਾਪਾ ਵੱਧ ਜਾਂਦਾ ਹੈ ਜਿਸ ਕਰਕੇ ਸਾਨੂੰ ਮੋਟਾਪੇ ਦੇ ਕਾਰਨ ਦਮਾ ਵੀ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਚੀਨੀ ਦੇ ਉੱਪਰ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਜਾਵੇ ਜਿਸ ਵਾਸਤੇ ਸਰੀਰ ਦੀ ਤੰਦਰੁਸਤੀ ਲਈ ਜਾਣਕਾਰੀ ਦਿੱਤੀ ਜਾਵੇ ਜੇਕਰ ਆਪਾਂ ਸਰੀਰ ਨੂੰ ਸੰਭਾਲ ਕੇ ਰੱਖਾਂਗੇ ਅਤੇ ਆਪਾਂ ਲੰਮੀ ਉਮਰ ਤੱਕ ਜੀ ਸਕਦੇ ਹਾਂ ਅਤੇ ਅਸੀਂ ਆਪਣੇ ਬੱਚਿਆਂ ਦੇ ਉੱਤੇ ਡਿਪੈਂਡ ਨਹੀਂ ਰਹਾਂਗੇ ਲੋਕ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦੇ ਅਤੇ ਬਾਅਦ ਦੇ ਵਿੱਚ ਬੱਚਿਆਂ 'ਤੇ ਡਿਪੈਂਡ ਹੋ ਜਾਂਦੇ ਹਨ ਅਤੇ ਬੱਚੇ ਬਾਅਦ ਵਿੱਚ ਮਾਂ ਬਾਪ ਦੀ ਪਰਵਾਹ ਨਹੀਂ ਕਰਦੇ ਅਤੇ ਉਹਨਾਂ ਨੂੰ ਬੋਝ ਲੱਗਦਾ ਹੈ ਸਰੀਰਕ ਤੰਦਰੁਸਤੀ ਲਈ ਤੁਸੀਂ ਆਪਣੇ ਆਪ ਨੂੰ ਵਧੇਰੇ ਰੱਖਣ ਲਈ ਨਿਯਮਾਂ ਦਾ ਪਾਲਣ ਰੱਖਣਾ ਚਾਹੀਦਾ ਹੈ ਅਤੇ ਸਰੀਰਕ ਦੀ ਤੰਦਰੁਸਤੀ ਰੱਬ ਦਾ ਇੱਕ ਬਹੁਤ ਵੱਡਾ ਸਾਨੂੰ ਗਿਫਟ ਮਿਲਿਆ ਹੋਇਆ ਹੈ ਕਿ ਇਸ ਕਰਕੇ ਆਪਣੇ ਸਰੀਰ ਦੀ ਸੰਭਾਲ ਰੱਖਣਾ ਸਾਡੀ ਨਿੱਜੀ ਜ਼ਿੰਮੇਵਾਰੀ ਹੈ